ਮੈਂ ਤਕਨੀਕੀ ਜਿਹੜੀ ਆਪਣੀ ਔਰ ਲਰਨਿੰਗ ਕਰਨਾ ਚਾਹੁੰਦਾ ਅਤੇ ਮੈਂ ਚਾਹੁੰਦਾ ਕਿ ਮੈਂ ਆਪਣੇ ਟੈਕਨੀਕਲ ਸਕਿਲ ਜਿਹੜੀ ਤਕਨੀਕੀ ਹੈ ਡਿਜੀਟਲ ਮਾਰਕੀਟਿੰਗ ਨੂੰ ਹੋਰ ਵਧਾਉਣਾ ਚਾਹੁੰਦਾ ਜੋ ਮੈਨੂੰ ਸਿੱਖਣ ਲਈ ਕੰਮ ਆਏ ਅਤੇ ਮੈਂ ਅੱਗੇ ਵੀ ਕਾਫੀ ਚੀਜ਼ਾਂ ਅੱਗੇ ਗਾਈਡ ਕਰ ਪਾਵਾਂ ਜਿਹੜੇ ਵੀ ਬੱਚੇ ਆਉਂਦੇ ਨੇ ਉਹਨਾਂ ਨੂੰ ਮਾਰਕਟਿੰਗ ਜਿਹੜੀ ਡਿਜੀਟਲ ਮਾਰਕੀਟਿੰਗ ਹੈ ਉਹਦੇ ਬਾਰੇ ਨਹੀਂ ਪਤਾ ਇੰਨੀ ਅਵੇਅਰਨੈਸ ਨਹੀਂ ਹੈਗੀ ਅਤੇ ਮੈਂ ਚਾਹੁੰਦਾ ਕਿ ਮੈਂ ਇਸ ਚੀਜ਼ ਨੂੰ ਸਿੱਖ ਕੇ ਅੱਗੇ ਔਰ ਤਰੀਕੇ ਅੱਗੇ ਔਰ ਵਧੀਆ ਤਰੀਕੇ ਨਾਲ ਮੈਂ ਅਵੇਅਰ ਕਰ ਪਾਵਾਂ ਸਾਰਿਆਂ ਨੂੰ ਅਤੇ ਮੇਰੀ ਇਹੀ ਇਹੀ ਚੀਜ਼ ਰਹਿੰਦੀ ਹੈ ਜੋ ਮੈਂ ਟੈਕਨੀਕਲੀ ਉਹ ਸਟਰੋਂਗ ਹੋਣਾ ਚਾਹਾਂਗਾ ਅਤੇ ਨਾਲ ਨਾਲ ਮੈਂ ਸਾਰਿਆਂ ਨੂੰ ਗਾਈਡ ਕਰਨਾ ਚਾਹਾਂਗਾ